ਵੈਸੇ ਤਾਂ ਸਾਰੇ ਹੀ ਪਕਵਾਨ ਪਵਾਰ ਪਰਿਵਾਰਿਕ ਹਨ ਪਰ ਜੋ ਕਿ ਸਾਡੇ ਘਰ ਵਿੱਚ ਬਹੁਤ ਪਸੰਦ ਕੀਤਾ ਜਾਣ ਵਾਲਾ ਪਰੀ ਪਕਵਾਨ ਹੈ ਉਹ ਹੈ ਸਰਸੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਜੋ ਕਿ ਪੁਰਾਤਨ ਸਮੇਂ ਵਿੱਚ ਤੋਂ ਚੱਲਿਆ ਆ ਰਿਹਾ ਹੈ ਇਹ ਮੇਰੀ ਦਾਦੀ ਦਾਦੇ ਦੇ ਟਾਈਮ ਤੋਂ ਬਣਦਾ ਹੈ ਮੇਰੇ ਦਾਦੀ ਜੀ ਨੇ ਮੇਰੀ ਮਾਤਾ ਜੀ ਨੂੰ ਬਣਾਉਣਾ ਸਿਖਾਇਆ ਮੇਰੇ ਮਾਤਾ ਜੀ ਮੈਨੂੰ ਬਣਾਉਣਾ ਸਿਖਾ ਰਹੇ ਹਨ ਅੱਜ ਕੱਲ੍ਹ ਮੈਂ ਵੀ ਥੋੜ੍ਹਾ ਬਹੁਤ ਸਾਗ ਬਣਾ ਲੈਂਦੀ ਹਾਂ ਸਾਗ ਬਣਾਉਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਣਾ ਪੈਂਦਾ ਹੈ ਫਿਰ ਉਬਾਲ ਕੇ ਤੜਕਾ ਲਗਾਉਣਾ ਪੈਂਦਾ ਹੈ ਅਤੇ ਮੱਕੀ ਦੀ ਰੋਟੀ ਨਾਲ ਖਾਇਆ ਜਾਣ ਵਾਲਾ ਸਾਗ ਬਹੁਤ ਹੀ ਸਵਾਦ ਲੱਗਦਾ ਹੈ ਵੈਸੇ ਤਾਂ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਾਗ ਪਸੰਦ ਹੈ ਬਟ ਉਹਨਾਂ ਨੂੰ ਹੋਰ ਵੀ ਚੀਜ਼ਾਂ ਪਸੰਦ ਹਨ ਜੋ ਕਿ ਮੈਂ ਹੌਲੀ ਹੌਲੀ ਬਣਾਉਣਾ ਸਿੱਖ ਰਹੀ ਹਾਂ ਅਤੇ ਮੈਨੂੰ ਸਿੱਖਣ ਵਿੱਚ ਬਹੁਤ ਰੁਚੀ ਹੈ